ਹਾਂਜੀ ਮੈਂ ਨਾ ਇੱਕ ਹੈਂਡ ਬੈਗ ਮੰਗਾਇਆ ਸੀ ਅਤੇ ਉਹ ਮੀਸ਼ੋ ਤੋਂ ਬਟ ਉਹ ਇੰਨਾ ਕੁ ਗੰਦਾ ਨਿਕਲਿਆ ਮੈਨੂੰ ਬਹੁਤ ਬੁਰਾ ਲੱਗਿਆ ਮੈਨੂੰ ਬੜੀ ਮੇਰੇ 'ਚ ਨੈਗਟੀਵਿਟੀਜ ਆਈ ਕਿ ਮੈਂ ਕਿਉਂ ਔਨਲਾਈਨ ਸ਼ੋਪਿੰਗ ਕਰੀ ਉਹਦੇ ਵਿੱਚ ਉਹਦੀ ਇੱਕ ਸਟਿਪ ਜਿਹੀ ਟੁੱਟੀ ਹੋਈ ਸੀ ਅਤੇ ਜੇਬਾਂ ਵਿੱਚੋਂ ਜਿਹੜੀਆਂ ਜ਼ਿੱਪਾਂ ਸੀ ਉਹ ਵੀ ਖਰਾਬ ਜਿਹੀਆਂ ਸੀਗੀਆਂ ਅਤੇ ਉਹ ਚੰਗੀ ਤਰ੍ਹਾਂ ਲੱਗ ਹੀ ਨਹੀਂ ਰਹੀਆਂ ਸੀ ਜ਼ਿੱਪਾਂ ਅਤੇ ਜੇਬ ਇੱਕ ਸਾਈਡ ਤੋਂ ਉਦੜੀ ਹੋਈ ਸੀ ਜਿਹਦੇ ਵਿੱਚੋਂ ਪੈਸੇ ਵੀ ਨਿਕਲ ਕੇ ਬੈਗ ਦੇ ਵਿੱਚ ਜਾ ਕੇ ਡਿੱਗ ਸਕਦੇ ਜਿੱਥੋਂ ਨਾ ਮੈਨੂੰ ਇਸ ਕਰਕੇ ਵਧੀਆ ਨਹੀਂ ਲੱਗਿਆ ਕਿਤੋਂ ਵੀ ਸ਼ੋਪਿੰਗ ਜਿਹੜੀ ਔਨਲਾਈਨ ਕਰਦੇ ਹਾਂ ਉਹਨੂੰ ਹੱਥ ਲਾ ਕੇ ਦੇਖਿਆ ਤਾਂ ਬੈਗ ਦਾ ਜਿਹੜਾ ਸਟਫ ਕੱਪੜਾ ਸੀ ਉਹ ਵੀ ਵਧੀਆ ਨਹੀਂ ਸੀ ਇੰਨਾ ਮੈਨੂੰ ਬਹੁਤ ਅਫਸੋਸ ਹੋਇਆ ਕਿ ਮੈਂ ਇਹਦੇ 'ਤੇ ਐਵੇਂ ਹੀ ਫਾਲਤੂ ਪੈਸੇ ਲਾਏ ਅਤੇ ਮੇਰਾ ਜੀਅ ਬਹੁਤ ਦੁਖੀਆ ਕਿਉਂਕਿ ਆਪਾਂ ਬਿਨਾਂ ਦੇਖੇ ਹੱਥ ਲਗਾਈ ਚੀਜ਼ ਮੰਗਾ ਤਾਂ ਲੈਂਦੇ ਆਨਲਾਈਨ ਬਟ ਜਦੋਂ ਇਹੋ ਜਿਹੀ ਇੱਦਾਂ ਦਾ ਪ੍ਰੋਡਕਟ ਆ ਜਾਂਦਾ ਫਿਰ ਬਹੁਤ ਦਿਲ ਦੁਖਦਾ ਕਿ ਪੈਸਾ ਲਾਇਆ ਖਰਾਬ ਗਿਆ ਨਾ ਫਿਰ ਉਹ ਕਿਤੇ ਚੱਕ ਕੇ ਲਿਜਾ ਸਕਦੇ ਹਾਂ ਬਸ ਘਰੇ ਹੀ ਪਿਆ ਰਹਿੰਦਾ ਉਹ ਚੀਜ਼ ਫਿਰ ਬੜਾ ਗੰਦਾ ਲੱਗਦਾ ਇਹ ਚੀਜ਼